ਸਤਿ ਸ਼੍ਰੀ ਅਕਾਲ ਆਂਟੀ ਜੀ ਹਾਂਜੀ ਠੀਕ ਹੋ ਜੀ ਘਰ ਬਾਰ ਸਾਰਾ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਠੀਕ ਹੈ ਜੀ ਮਾਲਕ ਦੀ ਕਿਰਪਾ ਹਾਂਜੀ ਆਂਟੀ ਠੀਕ ਹੈ ਜੀ ਅਤੇ ਆਂਟੀ ਮੈਨੇ ਹੁਣ ਜੋਬ ਦੇ ਕਰਕੇ ਮੇਰੀ ਇੱਥੇ ਬਦਲੀ ਹੋ ਗਈ ਸੀ ਮੁਕਤਸਰ ਪਹਿਲਾਂ ਤਾਂ ਮੈਂ ਇੱਧਰ ਹੀ ਸੀਗਾ ਆਪਣੇ ਦੋਦੇਆਲੇ ਪਿੰਡ ਸੀ ਰਹਿੰਦਾ ਤਾਂ ਹੁਣ ਮੁਕਤਸਰ ਆ ਗਿਆ ਅਤੇ ਫਿਰ ਮੈਨੂੰ ਔਖਾ ਹੋਣਾ ਇੱਥੇ ਰਹਿਣਾ ਕਰਨਾ ਅਤੇ ਇੱਥੇ ਮੈਨੂੰ ਦੱਸ ਸਕਦੇ ਹੋ ਵੀ ਆਪਣੇ ਸਬਜ਼ੀ ਵੀ ਫਰੈਸ਼ ਸਬਜ਼ੀ ਵਧੀਆ ਸਬਜ਼ੀ ਕਿੱਥੋਂ ਮਿਲਦੀ ਆ ਹੁਣ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਸਾਗ ਸੂਗ ਵਾਲੇ ਤਾਂ ਆ ਹੀ ਜਾਂਦੇ ਸਬਜ਼ੀ ਵਾਲੇ ਵੀ ਹੁਣ ਆ ਜਾਂਦੇ ਸੀ ਉਦੋਂ ਲੈ ਲਈਦੇ ਸੀ ਫਿਰ ਮੈਨੂੰ ਇੱਥੇ ਹੁਣ ਲੋਕੇਸ਼ਨ ਦਾ ਨਹੀਂ ਪਤਾ ਜਗ੍ਹਾ ਦਾ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਮਿਲਦੇ ਹਾਂਜੀ ਹਾਂਜੀ

ਅੱਛਾ ਜੀ ਦੋ ਮੰਡੀਆਂ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਊਂ ਆਹ ਵਧੀਆ ਕੁਆਲਿਟੀ ਦਾ ਹੁੰਦਾ ਹੈ ਜੀ ਅੱਛਾ ਜੀ ਨਹੀਂ ਕਈ ਵਾਰ ਹੁੰਦਾ ਨਾ ਗੰਦੇ ਨਾਲੇ ਨੂਲੇ ਦਾ ਅੱਛਾ ਜੀ ਔਰਗੈਨਿਕ ਹਾਂਜੀ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਫਿਰ ਆਮ ਹੀ ਤੁਹਾਨੂੰ ਪਤਾ ਹੀ ਆ ਫਿਰ ਪਿੰਡਾਂ 'ਚ ਖੇਤਾਂ ਕਰਕੇ ਫਿਰ ਉੱਥੋਂ ਆ ਹੀ ਜਾਂਦੇ ਰਹਿੰਦੇ ਆ ਸਾਗ ਸੂਗ ਹੁਣ ਸਰਦੀਆਂ 'ਚ ਫਿਰ ਸਾਗ ਸੂਗ ਚੱਲਦਾ ਫਿਰ ਜ਼ਿਆਦਾਤਰ ਫਿਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸਾਨੀ ਹੋ ਜਾਂਦੀ ਆ ਕਿਉਂਕਿ ਨਵਾਂ ਆਇਆ ਫਿਰ ਅਜੇ ਤੱਕ ਕੋਈ ਪਤਾ ਨਹੀਂ ਵੀ ਹੌਲੀ ਹੌਲੀ ਪਤਾ ਲੱਗਦਾ ਫਿਰ ਮੈਂ ਥੋ ਤੁਹਾਡੇ ਤੋਂ ਪੁੱਛ ਲਾਂ

ਹਾਂਜੀ ਹਾਂਜੀ ਹੋਰ ਇੱਥੇ ਕੱਪੜੇ ਕੁੱਪੜੇ ਦਾ ਕੀ ਰੇਟ ਆ ਜੀ ਕਿਉਂਕਿ ਕੱਪੜਾ ਦੇਖਣਾ ਕਿਉਂਕਿ ਲੁਧਿਆਣੇ ਵੀ ਕਹਿੰਦੇ ਸਸਤਾ ਇੱਥੇ ਮੁਕਤਸਰ ਦਾ ਕੀ ਰੇਟ ਰੁਟ ਆ ਸਸਤਾ ਮਿਲ ਜਾਂਦਾ ਅੱਛਾ ਜੀ ਹਾਂਜੀ ਬਸ ਸਬਜ਼ੀ ਦਾ ਪੁੱਛਣਾ ਸੀ ਜੀ ਮੈਂ ਅੱਛਾ ਜੀ ਮੇਨ ਤਾਂ ਸਬਜ਼ੀ ਦਾ ਹੀ ਪੁੱਛਦਾ ਸੀ ਮੈਂ ਕਿਉਂਕਿ ਫਿਰ ਮੈਂ ਕਿਹਾ ਪਤਾ ਨਹੀਂ ਸੀ ਮੈਨੂੰ ਹਾਂਜੀ ਹਾਂਜੀ ਸੁਬਹਾ ਕਿੰਨੇ ਵਜੇ ਖੁੱਲ੍ਹ ਜਾਂਦੀ ਏ ਮੰਡੀ ਅੱਛਾ ਜੀ ਚਾਰ ਵਜੇ ਅਤੇ ਕਿੰਨੇ ਕਿੰਨੇ ਟਾਈਮ ਤੱਕ ਖੁੱਲ੍ਹਦੀ ਰਹਿੰਦੀ ਆ ਖੁੱਲ੍ਹੀ ਰਹਿੰਦੀ ਆ ਠੀਕ ਹੈ ਜੀ

ਕੋਈ ਨਹੀਂ ਕੋਈ ਨਹੀਂ ਫਿਰ ਮੈਂ ਨਾ ਨਵਾਂ ਆਇਆ ਨਾ ਮੈਨੂੰ ਤਾਂ ਕਰਕੇ ਪਤਾ ਨਹੀਂ ਫਿਰ ਕਿਵੇਂ ਕਿਵੇਂ ਰਸਤਾ ਕਿਵੇਂ ਹੈ ਨਾ ਵੀ ਕਿੱਥੋਂ ਮਿਲਦਾ ਕਿੱਥੋਂ ਸਮਾਨ ਮਿਲ ਰਿਹਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੱਸਿਆ ਮੈਨੂੰ ਠੀਕ ਹੈ